ਜੋ ਸਵੱਛ ਭਾਰਤ ਅਭਿਆਨ ਸਰਕਾਰ ਵੱਲੋਂ ਚਲਾਇਆ ਗਿਆ ਸੀ ਜੋ ਕਿ ਕਾਫੀ ਉੱਦਮ ਯੋਗ ਉਪਰਾਲਾ ਸੀ ਕਿ ਆਪਾਂ ਗੰਦਗੀ ਤੋਂ ਬਚੀਏ ਅਤੇ ਆਪਣੇ ਜ਼ਿਲ੍ਹੇ ਨੂੰ ਆਪਣੇ ਪਿੰਡ ਨੂੰ ਆਪਣੇ ਸ਼ਹਿਰ ਨੂੰ ਆਪਣੇ ਦੇਸ਼ ਨੂੰ ਸਵੱਛ ਬਣਾਈਏ ਜਿਸ ਕਰਕੇ ਸਾਡੇ ਹਲਕੇ ਵੱਲੋਂ ਵੀ ਜੋ ਸਰਕਾਰ ਵੱਲੋਂ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਕਮੇਟੀਆਂ ਬਣਾਈਆਂ ਗਈਆਂ ਸੀ ਉਹਦੇ ਵਿੱਚ ਵੀ ਆਪਾਂ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਸ਼ਰੂਆਤ ਅਸੀਂ ਆਪਣੇ ਪਿੰਡਾਂ ਤੋਂ ਕੀਤੀ ਆਪਣੀ ਗਲੀਆਂ ਨਲ ਨਾਲੀਆਂ ਸਾਫ ਕਰਦੇ ਹੋਏ ਆਪਾਂ ਸ਼ਹਿਰ ਤੱਕ ਪਹੁੰਚੇ ਹਾਂ ਅਤੇ ਜਿੱਥੇ ਜਿੱਥੇ ਵੀ ਸਾਨੂੰ ਲੋੜ ਪਈ ਕਿ ਆਪਾਂ ਸਫਾਈ ਦੀ ਸਾਨੂੰ ਲੋੜ ਹੈ ਆਪਾਂ ਦੇਖ ਸਕਦੇ ਹਾਂ ਕਿ ਜਿੱਥੇ ਗੰਦਗੀ ਹੈ ਆਪਾਂ ਸਾਫ ਕਰੀਏ ਉੱਥੇ ਆਪਾਂ ਵੱਲੋਂ ਸਾ ਸਾਡੇ ਵੱਲੋਂ ਜਾਂ ਕਮੇਟੀਆਂ ਵੱਲੋਂ ਸਾਫ ਕੀਤਾ ਗਿਆ ਅਤੇ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਵੀ ਕਾਫੀ ਜੋ ਸ਼ਲਾਘਾਯੋਗ ਕਦਮ ਉਹ ਚੁੱਕੇ ਗਏ ਨੇ ਅਤੇ ਹਰ ਇੱਕ ਪਰਿਵਾਰ ਦੇ ਮੈਂਬਰ ਵੱਲੋਂ ਇਸ ਸ਼ਲਾਘਾਯੋਗ ਕਦਮ ਵਿੱਚ ਹਿੱਸਾ ਲਿਆ ਗਿਆ ਹੈ ਅਤੇ ਜੋ ਸਵੱਛਤਾ ਲਿਆਂਦੀ ਗਈ ਹੈ ਆਪਣੇ ਹਲਕੇ ਵਿੱਚ ਅਤੇ ਜਿਸਦਾ ਸਾਨੂੰ ਖੁਦ ਨੂੰ ਵੀ ਨਿੱਜੀ ਤੌਰ 'ਤੇ ਕਾਫੀ ਫਾਇਦਾ ਹੁੰਦਾ ਹੈ ਜਿਵੇਂ ਕਿ ਖੜ੍ਹਾ ਪਾਣੀ ਜੋ ਗੰਦਾ ਪਾਣੀ ਹੁੰਦਾ ਹੈ ਉਹਦੇ ਵਿੱਚ ਮੱਛਰ ਬਹਿਣ ਕਰਕੇ ਬਿਮਾਰੀਆਂ ਦਾ ਕਾਰਨ ਬਣਦਾ ਹੈ ਅਤੇ ਉਹ ਪਾਣੀ ਦੀ ਨਿਕਾਸੀ ਕਰਕੇ ਉਹ ਗੰਦਾ ਪਾਣੀ ਉੱਥੇ ਖੜ੍ਹਨਾ ਬੰਦ ਹੋ ਗਿਆ ਇਸ ਕਰਕੇ ਕਾਫੀ ਲੋਕਾਂ ਨੂੰ ਬਿਮਾਰੀਆਂ ਤੋਂ ਵੀ ਰਾਹਤ ਜੋ ਮਿਲੀ ਹੈ